ਕਈ ਪ੍ਰਕਾਰ ਦੀਆਂ ਪ੍ਰਸਿੱਧ ਮਨੋਰੰਜਕ ਗਤੀਵਿਧੀਆਂ ਜਾਂ ਸਾਹਸੀ ਖੇਡਾਂ ਹਨ ਜੋ ਅਸੀਂ ਸੈਲਾਨੀ ਪੰਜਾਬ ਦੇ ਜਾਣ ਵੇਲੇ ਅਜ਼ਮਾ ਸਕਦੇ ਹਾਂ ਜਿਵੇਂ ਕਿ ਗੱਲ ਕਰੀਏ ਤਾਂ ਪੰਜਾਬ ਵਿੱਚ ਕਈ ਤਰ੍ਹਾਂ ਦੇ ਵੋਟਰ ਪਾਰਕ ਅਤੇ ਅਮਿਊਜਮੈਂਟ ਪਾਰਕ ਖੁੱਲ੍ਹ ਚੁੱਕੇ ਹਨ ਇੱਥੋਂ ਦੇ ਫੇਮਸ ਪਾਰਕ ਦੀ ਗੱਲ ਕਰੀਏ ਤਾਂ ਉਹ ਹੈ ਰੈਂਬੋ ਰਿਜੋਰਟਸ ਵੋਟਰ ਪਾਰਕ ਸਨਸਿਟੀ ਚਿਰਾਗ ਵਾਈਟ ਵੋਟਰ ਐਂਡ ਅਮਿਊਜਮੈਂਟ ਰਾਈਡਸ ਅਤੇ ਹਾਰਡਇਜ਼ ਵਰਲਡ ਇਹ ਸਭ ਪੰਜਾਬ ਦੇ ਫੇਮਸ ਵੋਟਰ ਪਾਰਕਸ ਹਨ ਅਸੀਂ ਵੋਟਰ ਪਾਰਕਸ ਇਸ ਲਈ ਜਾਂਦੇ ਹਾਂ ਕਿਉਂਕਿ ਅਸੀਂ ਆਪਣੇ ਫੈਮਲੀ ਨਾਲ ਟਾਈਮ ਸਪੈਂਡ ਕਰਦੇ ਹਾਂ ਅਤੇ ਸਾਡੇ ਮਨ ਨੂੰ ਬਹੁਤ ਹੀ ਸ਼ਾਂਤੀ ਮਿਲਦੀ ਹੈ ਮੈਂ ਵੀ ਲਾਸਟ ਟਾਈਮ ਹਾਰਡਇਜ਼ ਵਰਲਡ ਗਈ ਸਾਂ ਅਤੇ ਮੇਰੇ ਪੇਰੈਂਟਸ ਵੀ ਮੇਰੇ ਨਾਲ ਸੀ ਜਦੋਂ ਮੈਂ ਉੱਥੇ ਐਂਟਰ ਕੀਤਾ ਮੈਂ ਕਈ ਵੋਟਰ ਰਾਈਡਸ ਲਿੱਤੀਆਂ ਜਦੋਂ ਅਸੀਂ ਵੋਟਰ ਪਾਰਕ ਦੇ ਵਿੱਚ ਐਂਟਰ ਕੀਤਾ ਤਾਂ ਉੱਥੋਂ ਦੀਆਂ ਬੇਵਜ ਨੇ ਮੇਰੇ ਮਨ 'ਤੇ ਬਹੁਤ ਹੀ ਚੰਗਾ ਪ੍ਰਭਾਵ ਪਾਇਆ ਮੈਨੂੰ ਵੋਟਰ ਪਾਰਕ ਜਾ ਕੇ ਬਹੁਤ ਹੀ ਵਧੀਆ ਲੱਗਾ ਇਸ ਲਈ ਅਸੀਂ ਕਈ ਤਰ੍ਹਾਂ ਦੀਆਂ ਵੋਟਰ ਪਾਰਕਸ ਅਤੇ ਅਮਿਊਜਮੈਂਟ ਪਾਰਕ ਵਿੱਚ ਜਾ ਸਕਦੇ ਹਾਂ ਜਿਹਦੇ ਰੇਟਸ ਬਹੁਤ ਹੀ ਜੈਨੂਅਨ ਹੁੰਦੇ ਹਨ ਅਤੇ ਸਾਡੇ ਮਨ ਦੇ ਉੱਪਰ ਇਹ ਬਹੁਤ ਹੀ ਵਧੀਆ ਪ੍ਰਭਾਵ ਪਾਉਂਦੇ ਹਨ